ਮੇਰਾ ਨਾਮ ਨੈਂਨਸੀ ਹੈ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਮਾਹੌਲ ਬਾਰੇ ਦੱਸਣਾ ਚਾਹੁੰਦੀ ਹਾਂ ਅੰਮ੍ਰਿਤਸਰ ਪੰਜਾਬ ਦੀ ਪੁਰਾਣੀ ਜਗ੍ਹਾ ਹੈ ਇੱਥੇ ਘੁੰਮਣ ਲਈ ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਅਤੇ ਉੱਥੇ ਦਾ ਮਾਹੌਲ ਵੀ ਬਹੁਤ ਵਧੀਆ ਹੈ ਉੱਥੇ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ ਲੋਕ ਉੱਥੇ ਮੱਥਾ ਵੀ ਟੇਕਦੇ ਹਨ ਅਤੇ ਉੱਥੋਂ ਦਾ ਖਾਣ ਪੀਣ ਵੀ ਬਹੁਤ ਵਧੀਆ ਹੈ ਅੰਮ੍ਰਿਤਸਰ ਵਿੱਚ ਬਹੁਤ ਸਾਰੀਆਂ ਘੁੰਮਣ ਵਾਲੀਆਂ ਅਤੇ ਵੇਖਣ ਯੋਗ ਥਾਵਾਂ ਹਨ ਉੱਥੇ ਹਰ ਦਿਨ ਲੋਕ ਆਉਂਦੇ ਜਾਂਦੇ ਹਨ ਜਦੋਂ ਇੱਕ ਵਾਰੀ ਵਿਅਕਤੀ ਉੱਥੇ ਚਲ ਜਾਵੇ ਤਾਂ ਵਾਪਸ ਆਉਣ ਦਾ ਦਿਲ ਨਹੀਂ ਕਰਦਾ ਅੰਮ੍ਰਿਤਸਰ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਲੋਕ ਗੱਲਬਾਤ ਕਰਦੇ ਹਨ ਅਤੇ ਬਹੁਤ ਹੀ ਵਧੀਆ ਉਸਨੂੰ ਰੱਖਦੇ ਹਨ